ਹੈਲੋ ਸਤਿ ਸ਼੍ਰੀ ਅਕਾਲ ਮੈਮ ਜਿਵੇਂ ਕਿ ਮੈਮ ਅਸੀਂ ਅੱਜ ਅੰਮ੍ਰਿਤਸਰ ਆਏ ਹਾਂ ਅਤੇ ਮੈਨੂੰ ਇੱਥੋਂ ਦੇ ਕੁਝ ਹਿਸਟੋਰੀਕਲ ਅਤੇ ਇਤਿਹਾਸਿਕ ਗੁਰਦੁਆਰਿਆਂ ਬਾਰੇ ਜਾਣਕਾਣੀ ਜਾਣਕਾਰੀ ਦਉਂਗੇ ਮੈਨੂੰ ਬਹੁਤ ਇੱਛਾ ਹੈ ਇੱਥੋਂ ਦੇ ਗੁਰਦੁਆਰਿਆਂ ਬਾਰੇ ਜਾਨਣ ਦੀ

ਹਾਂਜੀ

ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ ਠੀਕ ਹੈ ਮੈਮ ਧੰਨਵਾਦ